ਮੈਂ ਆਪਣੇ ਨਜਜ਼ੀਕੀ ਧਾਰਮਿਕ ਸਥਾਨ ਗੁਰੂਦਵਾਰਾ ਭੱਠਾ ਸਾਹਿਬ ਵਿੱਚ ਜਾਂਦਾ ਹਾਂ ਜਿੱਥੇ ਜਾ ਕੇ ਮੈਂ ਪਾਠ ਸੁਣਦਾ ਹਾਂ ਅਤੇ ਮੈਨੂੰ ਗੁਰਬਾਣੀ ਸੁਣਨ ਵਿੱਚ ਬਹੁਤ ਆਨੰਦ ਆਂਦ ਆਉਂਦਾ ਹੈ ਅਤੇ ਮੈਂ ਪਰਮਾਤਮਾ ਅੱਗੇ ਬੇਨਤੀ ਕਰਦਾ ਹਾਂ ਕਿ ਉਹ ਮੇਰੇ ਪਰਿਵਾਰ ਵਿੱਚ ਖੁਸ਼ੀ ਅਤੇ ਸ਼ਾਂਤੀ ਬਣਾਈ ਰੱਖੇ ਜਿੱਥੇ ਦੇ ਲੰਗਰ ਸਾਹਿਬ ਵਿੱਚ ਮੈਨੂੰ ਸੇਵਾ ਕਰਕੇ ਬਹੁਤ ਖੁਸ਼ੀ ਪ੍ਰਾ ਮਿਲਦੀ ਹੈ ਅਤੇ ਮੈਂ ਰੋਜ਼ ਇਸ ਨਜ਼ਾਰੇ ਦਾ ਆਨੰਦ ਲੈਂਦਾ ਹਾਂ